ਹੈਲੋ ਕਸਟਮਰ ਕੇਅਰ ਮੈਂ ਊਬਰ ਬੁਕ ਕੀਤੀ ਸੀ ਸਤਾਰਾਂ ਤੋਂ ਸੈਕਟਰ ਸਤਾਰਾਂ ਤੋਂ ਸੈਕਟਰ ਵੀਹ ਤੱਕ ਸ ਗ ਸੈਕ ਡਰਾਈਵਰ ਦਾ ਨਾਮ ਪ੍ਰੀਤ ਇੰਦਰ ਸਿੰਘ ਮੈਂ ਊਬਰ ਕੈਸ਼ 'ਤੇ ਕੀਤੀ ਸੀ ਬਟ ਮੈਂ ਕਾਹਲੀ ਵਿੱਚ ਆਪਣਾ ਪਰਸ ਘਰ ਭੁੱਲ ਆਈ ਹਾਂ ਕੀ ਮੈਂ ਤੁਹਾਨੂੰ ਔਨਲਾਈਨ ਭੁਗਤਾਨ ਕਰ ਸਕਦੀ ਹਾਂ ਜੇ ਕਰ ਸਕਦੀ ਹਾਂ ਤਾਂ ਮੈਂ ਕਿਹੜੇ ਸੋਰਸ 'ਤੇ ਤੁਹਾਨੂੰ ਔਨਲਾਈਨ ਭੁਗਤਾਨ ਕਰ ਸਕਦੀ ਹਾਂ ਜਿਵੇਂ ਫੋਨਪੇ 'ਤੇ ਕਰ ਸਕਦੇ ਹਾਂ ਜਾਂ ਫਿਰ ਗੂਗਲ ਪੇ 'ਤੇ ਜਾਂ ਫਿਰ ਪੇਟੀਐਮ ਰਾਹੀਂ ਕਿਸ ਚੀਜ਼ ਨਾਲ ਆਪਾਂ ਭੁਗਤਾਨ ਕਰ ਸਕਦੇ ਹਾਂ ਤਾਂ ਜੋ ਮੈਂ ਆਪਣੇ ਕੰਮ 'ਤੇ ਸਹੀ ਟਾਈਮ 'ਤੇ ਪਹੁੰਚ ਸਕਾਂ ਕੀ ਤੁਸੀਂ ਔਨਲਾਈਨ ਭੁਗਤਾਨ ਲੈ ਸਕਦੇ ਹੋ ਕਿਉਂਕਿ ਅੱਜ ਕੱਲ੍ਹ ਨਕਦ ਕੈਸ਼ ਕੈਸ਼ 'ਤੇ ਕੰਮ ਕਿਉਂਕਿ ਅੱਜ ਕੱਲ੍ਹ ਕੈਸ਼ 'ਤੇ ਕੈਸ਼ ਘੱਟ ਯੂਜ਼ ਕਰਦੇ ਨੇ ਤਾਂ ਫਿਰ ਮੈਂ ਔਨਲਾਈਨ ਭੁਗਤਾਨ ਕਰ ਸਕਦੀ ਹਾਂ